ਸਾਡੇ ਪਿੰਡ ਬਾਰਨ ਵਿੱਚ ਬਹੁਤ ਤਰ੍ਹਾਂ ਦੀਆਂ ਕੁਪੋਸ਼ਣ ਦੀਆਂ ਬਿਮਾਰੀਆਂ ਹਨ ਜਿਵੇਂ ਕਿ ਇੱਥੇ ਥਾਇਰਡ ਜਾਂ ਸਰਵਾਈਕਲ ਜਾਂ ਪੇਟ ਦੀਆਂ ਬਿਮਾਰੀਆਂ ਬਹੁਤ ਪੈਦਾ ਹੋ ਰਹੀਆਂ ਹਨ ਇਸ ਦਾ ਕਾਰਣ ਸਾਡੇ ਪਿੰਡ ਕੋਲੋਂ ਵੱਗਦਾ ਇੱਕ ਬਹੁਤ ਸਾਰਾ ਗੰਦਾ ਪਾਣੀ ਜੋ ਕਿ ਪੀਣ ਵਾਲੇ ਸਾਫ ਪਾਣੀ ਵਿੱਚ ਕਿਤੇ ਕਿਤੇ ਜਾਂ ਕਿਸੇ ਵੀ ਤਰੀਕਾਂ ਪਾਇਪ ਲਾਇਨ ਵਿੱਚੋਂ ਮਿਕਸ ਹੁੰਦਾ ਜਾ ਰਿਹਾ ਹੈ ਇਸ ਦਾ ਨੁਕਸਾਨ ਬਹੁਤ ਜ਼ਿਆਦਾ ਹਰ ਇੱਕ ਵਰਗ ਦੇ ਲੋਕਾਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਹੋ ਰਿਹਾ ਹੈ ਅਤੇ ਹਰ ਇੱਕ ਪਰਿਵਾਰ ਇਸ ਚੀਜ਼ ਤੋਂ ਪੀੜਿਤ ਹੈ ਅਤੇ ਜੋ ਵੀ ਸਬਜ਼ੀਆਂ ਦੀ ਇੱਥੇ ਪੈਦਾਵਾਰ ਹੁੰਦੀ ਹੈ ਉਸ ਵਿੱਚ ਵੀ ਉਹ ਗੰਦਾ ਪਾਣੀ ਸੀਵਰੇਜ ਦਾ ਮਿਕਸ ਹੁੰਦਾ ਜਾ ਰਿਹਾ ਹੈ ਜਿਸ ਨਾਲ ਕਿ ਹਰੇਕ ਇਨਸਾਨ ਤੰਗ ਹੋ ਰਿਹਾ ਹੈ ਅਤੇ ਡਾਕਟਰ ਤੱਕ ਸਹੂਲਤ ਲੈ ਰਿਹਾ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਾਡੇ ਪਿੰਡ ਨੇ ਇੱਕ ਐਪਲੀਕੇਸ਼ਨ ਡੀ ਸੀ ਅੋੋਫਿਸ ਨੂੰ ਵੀ ਮਾਰਕ ਕੀਤੀ ਹੈ ਜੋ ਕਿ ਸਾਡੇ ਪਿੰਡ ਨੂੰ ਇੱਕ ਡਿਸਪੈਂਸਰੀ ਅਤੇ ਇੱਕ ਸਪੈਸ਼ਲ ਟੀਮ ਬਣਾ ਕੇ ਸਾਡੇ ਪਿੰਡ ਦੀ ਸਮੱਸਿਆ ਨੂੰ ਹੱਲ ਕਰਨ ਬਾਰੇ ਬਹੁਤ ਹੀ ਵੱਡੀ ਮੁਹਿੰਮ ਬਣਾ ਰਹੇ ਹਨ